ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਮੈਂ ਹੁਣੇ ਥੋੜ੍ਹੇ ਚਿਰ ਪਹਿਲਾਂ ਹੀ ਤੁਹਾਡੀ ਕੰਪਨੀ ਕੋਲੋਂ ਸਕੂਲ ਟੈਕਸਟ ਬੁੱਕਸ ਦਾ ਔਡਰ ਕੀਤਾ ਸੀਗਾ ਉਸ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਕਿ ਹਾਂਜੀ ਮੈਨੂੰ ਨਾ ਮੇਰੀ ਫਰੈਂਡ ਨੇ ਤੁਹਾਡੀ ਕੰਪਨੀ ਬਾਰੇ ਦੱਸਿਆ ਸੀਗਾ ਕਿ ਤੁਸੀਂ ਔਨਲਾਈਨ ਬੜੇ ਹੀ ਵਧੀਆ ਰੇਟ ਦੇ ਉੱਪਰ ਸਕੂਲ ਟੈਕਸ ਬੁੱਕਸ ਜਿਹੜੀਆਂ ਨੇ ਉਹ ਪ੍ਰੋਵਾਈਡ ਕਰਦੇ ਸੀ ਮੈਨੂੰ ਮੇਰੀ ਫਰੈਂਡ ਦੇ ਨਾਲ ਮੈਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਬਾਜ਼ਾਰ ਗਈ ਜਿੱਥੇ ਕਿ ਮੈਨੂੰ ਬੁੱਕਸ ਮਿਲ ਵੀ ਗਈਆਂ ਪਰ ਉਹਨਾਂ ਦਾ ਪ੍ਰਾਈਜ਼ ਜਿਹੜਾ ਸੀਗਾ ਉਹ ਮੈਨੂੰ ਕਾਫ਼ੀ ਜ਼ਿਆਦਾ ਲੱਗਿਆ ਅਤੇ ਉਹਨਾਂ ਦੀ ਕੰਡੀਸ਼ਨ ਵੀ ਬੁੱਕਸ ਦੀ ਜਿਹੜੀ ਸੀ ਉਹ ਖ਼ਰਾਬ ਸੀਗੀ ਫਿਰ ਉਹਨੇ ਮੈਨੂੰ ਦੱਸਿਆ ਕਿ ਹਾਂਜੀ ਤੁਹਾਡੀ ਜਿਹੜੀ ਕੰਪਨੀ ਹੈਗੀ ਹੈ ਉਹ ਇਸ ਤਰ੍ਹਾਂ ਬੁੱਕਸ ਦੀ ਡੀਲਿੰਗ ਕਰਦੀ ਹੈਗੀ ਆ ਔਨਲਾਈਨ ਅਤੇ ਬੜੀ ਹੀ ਛੇਤੀ ਇੱਕ ਤਾਂ ਤੁਸੀਂ ਬੁੱਕਸ ਪਹੁੰਚਾ ਦਿੰਦੇ ਹੋ ਡੋਰ ਸਟੈੱਪ 'ਤੇ ਬਿਲਕੁਲ ਅਤੇ ਨਾਲੇ ਕੁਆਲਿਟੀ ਜਿਹੜੀ ਹੈ ਉਹਦੇ ਵਿੱਚ ਵੀ ਕਿਸੇ ਤਰੀਕੇ ਦਾ ਕੰਪਰੋਮਾਈਜ਼ ਨਹੀਂ ਕਰਦੇ ਸੋ ਮੈਂ ਤੁਹਾਡੀ ਹੀ ਸਾਈਟ ਦੇ ਉੱਪਰੋਂ ਕਹਿ ਲਓ ਕਿ ਬੁੱਕਸ ਦੀ ਔਡਰ ਕੀਤੀ ਘੱਟ ਤੋਂ ਘੱਟ ਛੇ ਸੱਤ ਬੁੱਕਸ ਜਿਹੜੀਆਂ ਸੀ ਉਹ ਹੈਗੀਆਂ ਸੀਗੀਆਂ ਹਾਂਜੀ ਪੈਕੇਜਿੰਗ ਜਿਹੜੀ ਸੀਗੀ ਉਹ ਜਦੋਂ ਮੇਰੇ ਕੋਲ ਪਾਰਸਲ ਆਇਆ ਤਾਂ ਮੈਂ ਉਹਨੂੰ ਦੇਖ ਕੇ ਬੜੀ ਖੁਸ਼ ਹੋਈ ਕਿਉਂਕਿ ਮੈਨੂੰ ਉਹਦੀ ਪੈਕਜਿੰਗ ਜਿਹੜੀ ਸੀ ਉਹ ਬਹੁਤ ਹੀ ਪਸੰਦ ਆਈ ਫਿਰ ਜਦੋਂ ਮੈਂ ਬੁੱਕਸ ਨੂੰ ਖੋਲ੍ਹਿਆ ਤਾਂ ਜਿਹੜੀ ਸਭ ਤੋਂ ਪਹਿਲਾਂ ਉਹਦੇ ਉੱਪਰ ਬੁੱਕ ਪਈ ਹੋਈ ਸੀਗੀ ਉਹਦਾ ਜਿਹੜੇ ਹੈਗੀ ਸੀ ਬਾਹਰ ਵਾਲਾ ਕਵਰ ਸੀ ਉਹ ਬਿਲਕੁਲ ਫਟਿਆ ਸੀਗਾ ਮੈਨੂੰ ਲੱਗਿਆ ਕਿ ਚਲੋ ਕਿਸੇ ਵੇਲੇ ਇੱਧਰ ਉੱਧਰ ਸ਼ਿਪਿੰਗ ਦੇ ਦੌਰਾਨ ਇਸ ਤਰ੍ਹਾਂ ਖ਼ਰਾਬੀ ਆ ਜਾਂਦੀ ਹੈ ਕੋਈ ਚੱਕਰ ਨਹੀਂ ਹੈਗਾ ਪਰ ਬਾਕੀਆਂ ਜਿਹੜੀਆਂ ਬੁੱਕਸ ਜਿਹੜੀਆਂ ਸੀਗੀਆਂ ਮੈਂ ਜਦੋਂ ਉਹਨਾਂ ਨੂੰ ਵੀ ਦੇਖਿਆ ਤਾਂ ਕਿਸੇ ਦੇ ਵਿੱਚ ਜਿਹੜੇ ਪੇਜਿਸ ਹੈ ਉਹਨਾਂ ਦੀ ਪ੍ਰਿੰਟਿੰਗ ਨਹੀਂ ਸੀ ਸਹੀ ਤਰ੍ਹਾਂ ਹੋਈ ਕਿਤਿਓਂ ਪੇਜਿਸ ਬਿਲਕੁਲ ਹੀ ਵਾਈਟ ਹੈਗੇ ਸੀਗੇ ਅਤੇ ਕਈ ਜਿਹੜੀਆਂ ਬੁਲਕ ਬੁੱਕਸ ਸੀਗੀਆਂ ਉਹ ਬਿਲਕੁਲ ਹੀ ਫਟੀਆਂ ਹੋਈਆਂ ਸੀਗੀਆਂ ਸੋ ਮੈਨੂੰ ਜਿੰਨੀ ਹੀ ਖੁਸ਼ੀ ਤੁਹਾਡੇ ਕਵਰ ਦੇਖ ਕੇ ਹੋਈ ਸੀ ਉੰਨਾ ਹੀ ਮੇਰਾ ਮਨ ਜਿਹੜਾ ਸੀ ਉਹ ਨਿਰਾਸ਼ ਹੋਇਆ ਜਦੋਂ ਮੈਂ ਉਹਨਾਂ ਬੁੱਕਸ ਦੀ ਹਾਲਤ ਦੇਖੀ ਅਤੇ ਅਸਲ ਵਿੱਚ ਕਈਆਂ ਦੇ ਤਾਂ ਪਬਲਿਸ਼ਰ ਵੀ ਉਹ ਨਹੀਂ ਸੀ ਜਿਹੜੇ ਮੈਂ ਮੰਗਵਾਏ ਸੀਗੇ ਸੋ ਮੈਨੂੰ ਤੁਹਾਡੀ ਸਰਵਿਸ ਜਿਹੜੀ ਹੈ ਉਸਨੇ ਬੜਾ ਹੀ ਪਰੇਸ਼ਾਨ ਕੀਤਾ ਇਸ ਤੋਂ ਚੰਗਾ ਤਾਂ ਸ਼ਾਇਦ ਜੇ ਮੈਂ ਥੋੜ੍ਹਾ ਜ਼ਿਆਦਾ ਪੈਸੇ ਦੇ ਕੇ ਸ਼ੋਪ ਤੋਂ ਲੈ ਲੈਂਦੀ ਤਾਂ ਉਹ ਬੈਟਰ ਰਹਿਣਾ ਸੀ ਅਤੇ ਜੇ ਮੈਂ ਆਪਣੇ ਪੈਸਿਆਂ ਦੀ ਰੀਫੰਡ ਮੰਗ ਰਹੀ ਹਾਂ ਤਾਂ ਉਹ ਵੀ ਬਿਲਕੁਲ ਕੋਈ ਵੀ ਉਸ 'ਤੇ ਗਵਾਹੀ ਨਹੀਂ ਕੀਤੀ ਜਾ ਰਹੀ ਸੋ ਸਰ ਮੈਂ ਇਹ ਹੀ ਕਹਿਣਾ ਚਾਹੇਗਾ ਚਾਵਾਂਗੀ ਕਿ ਤੁਸੀਂ ਪਲੀਜ਼ ਆਪਣੀ ਇਹ ਜਿਹੜੀ ਸਰਵਿਸ ਹੈ ਇਹਨੂੰ ਥੋੜ੍ਹਾ ਜਿਹਾ ਇਹਦੇ ਵਿੱਚ ਸੁਧਾਰ ਲਿਆਓ ਤਾਂ ਕਿ ਤੁਹਾਡੇ ਜਿਹੜੇ ਕਸਟਮਰ ਹੈ ਉਹਨਾਂ ਨੂੰ ਇਹਨਾਂ ਮੁਸ਼ਕਿਲਾਂ ਦਾ ਦੁਬਾਰਾ ਤੋਂ ਸਾਹਮਣਾ ਨਾ ਕਰਨਾ ਪਵੇ ਧੰਨਵਾਦ